ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਆਪ ਜੀ ਨੇ ਪੁੱਛਿਆ ਕਿ ਤੁਹਾਡੀ ਮਨਪਸੰਦ ਗੇਮ ਕਿਹੜੀ ਹੈ ਤੇ ਅਤੇ ਕਿਉਂ ਪਸੰਦ ਹੈ ਮੇਰੀ ਮਨਪਸੰਦ ਗੇਮ ਜਿੱਦਾਂ ਕਿ ਲੂਡੋ ਹੈ ਲੂਡੋ ਗੇਮ ਇਸ ਤਰ੍ਹਾਂ ਦੀ ਹੈ ਕਿ ਇਹ ਅਸੀਂ ਫੈਮਲੀ ਵਿੱਚ ਬੈਠ ਕੇ ਵੀ ਖੇਡ ਸਕਦੇ ਹਾਂ ਇਸ ਵਿੱਚ ਖੇਡਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ ਜਿਸ ਕਾਰਨ ਸਾਨੂੰ ਟਾਈਮ ਦਾ ਵੀ ਪਤਾ ਨਹੀਂ ਚੱਲਦਾ ਫ੍ਰੀ ਟਾਈਮ 'ਤੇ ਅਸੀਂ ਘਰ ਕਦੀ ਬੱਚਿਆਂ ਨਾਲ ਕਦੀ ਆਪਣੇ ਵੱਡਿਆਂ ਨਾਲ ਇਹ ਗੇਮ ਖੇਡਦੇ ਹਾਂ ਇਹ ਗੇਮ ਖੇਡਣ ਨਾਲ ਸਾਨੂੰ ਬਹੁਤ ਹੀ ਅਨੰਦ ਆਉਂਦਾ ਹੈ ਇਸ ਕਰਨ ਲਈ ਮੈਨੂੰ ਇਹ ਗੇਮ ਬਹੁਤ ਹੀ ਪਸੰਦ ਹੈ ਜਿੱਦਾਂ ਕਿ ਲੂਡੋ ਗੇਮ ਇਹ ਇਸ ਤਰ੍ਹਾਂ ਪਸੰਦ ਹੈ ਕਿਉਂਕਿ ਇਹ ਅਸੀਂ ਆਪਣੀ ਬਣਾਈ ਹੋਈ ਲੂਡੋ ਗੇਮ ਘਰ ਵਿੱਚ ਬੈਠ ਕੇ ਹੀ ਖੇਡ ਸਕਦੇ ਹਾਂ ਨਾ ਕਿ ਫੋਨ ਦੇ ਵਿੱਚ ਸਾਨੂੰ ਲੂਡੋ ਗੇਮ ਮੈਨੂੰ ਬਹੁਤ ਹੀ ਪਸੰਦ ਹੈ